ਹਾਂਜੀ ਸਟਾਰਗੇਜਿੰਗ ਨੂੰ ਮੈਂ ਦੋਸਤਾਂ ਜਾਂ ਪਰਿਵਾਰ ਨਾਲ ਆਪਣੇ ਬੰਧਨ ਨੂੰ ਗੂੜ੍ਹਾ ਕਰਨ ਦੇ ਤਰੀਕੇ ਨਾਲ ਜ਼ਰੂਰ ਵਰਤਿਆ ਪਰਿਵਾਰ ਨਾਲ ਮੈਂ ਬਚਪਨ ਵਿੱਚ ਜ਼ਰੂਰ ਵਰਤਿਆ ਹੋਏਗਾ ਜਿੱਥੋਂ ਤੱਕ ਮੈਨੂੰ ਕਿਉਂਕਿ ਹੁਣ ਤਾਂ ਮੈਨੂੰ ਯਾਦ ਨਹੀਂ ਪਰ ਜਿਵੇਂ ਬਚਪਨ ਵਿੱਚ ਉੱਤੇ ਕਈ ਵਾਰ ਕੋਠੇ ਦੇ ਉੱਪਰ ਸੌਂਦੇ ਹੋਏ ਤਾ ਤਾਰੇ ਵੇਖਦੇ ਵੇਖਦੇ ਗੱਲਾਂ ਕਰਨੀਆਂ ਹਾਂ ਆਪਦੀ ਦਾਦੀ ਨਾਲ ਬਾਤਾਂ ਮਾਰਨੀਆਂ ਮੇਰੇ ਦਾਦੀ ਜੀ ਹਮੇਸ਼ਾ ਹੁਣ ਹੁਣ ਵੀ ਕਈ ਵਾਰ ਕਰਦੇ ਹਾਂ ਪਰ ਜ਼ਿਆਦਾਤਰ ਬਚਪਨ ਵਿੱਚ ਹੀ ਹੁੰਦਾ ਸੀ ਜਿਵੇਂ ਮੇਰੇ ਅਤੇ ਮੇਰੇ ਭਰਾ ਨੂੰ ਦਾਦੀ ਆਪਦੇ ਨਾਲ ਮੰਜੇ 'ਤੇ ਪਾ ਕੇ ਹਮੇਸ਼ਾ ਬਾਤਾਂ ਪਾਉਂਦੇ ਬੁਝਾਰਤਾਂ ਪਾਉਂਦੇ ਤਾਂ ਫਿਰ ਅਸੀਂ ਗੱਲਾਂ ਕਰਦੇ ਇਸ ਤਰ੍ਹਾਂ ਨਾਲੇ ਅਸੀਂ ਤਾਰੇ ਵੇਖਦੇ ਨਾਲੇ ਅਸੀਂ ਬਾਤਾਂ ਬਾਤਾਂ ਬਾਤਾਂ ਸੁਣਦੇ ਅਤੇ ਨਾਲੇ ਬੁਝਾਰਤਾਂ ਬੁੱਝਦੇ ਇਸ ਦੇ ਨਾਲ ਕਈ ਕਹਾਣੀਆਂ ਵੀ ਸੁਣਾਉਂਦੇ ਕਿੰਨੇ ਰਾ ਕਿਹੜੇ ਰਾਜੇ ਦੀਆਂ ਮਹਾਰਾਜਾ ਦੀਆਂ ਸਾਰਿਆਂ ਦੀਆਂ ਅਸੀਂ ਕਹਾਣੀਆਂ ਸੁਣਦੇ ਇਸ ਦੇ ਨਾਲ ਜਿਵੇਂ ਕਈ ਵਾਰ ਦੋਸਤਾਂ ਦੇ ਨਾਲ ਵੀ ਹੁੰਦਾ ਅਸੀਂ ਬੈਠੇ ਹਾਂ ਤਾਰੇ ਵੇਖਦੇ ਹਾਂ ਤਾਂ ਫਿਰ ਆਪ ਦੇ ਕਈ ਵਾਰ ਪੁਰਾਣੀਆਂ ਬਚਪਨ ਦੀ ਯਾਦਾਂ ਆ ਜਾਂਦੀਆਂ ਹਨ ਜਾਂ ਫਿਰ ਕਈ ਕੋਈ ਇਹੋ ਜਿਹੇ ਐਨਿਕ ਡੋਟ ਹੁੰਦੇ ਹਨ ਜਿਹੜੇ ਕਿ ਯਾਦ ਆ ਜਾਂਦੇ ਹਨ ਜਿਵੇਂ ਕੋਈ ਵੀ ਚੀਜ਼ ਹੋਏ ਕੋਈ ਵੀ ਚੰਗੇ ਚੰਗੇ ਪਲ ਹੋਣ ਹੋ ਕੇ ਆਪਾਂ ਆਪਦੀ ਜ਼ਿੰਦਗੀ ਦੇ ਉਹਨਾਂ ਨਾਲ ਸਾਂਝੇ ਕਰ ਸਕਦੇ ਹਾਂ ਉਹਨਾਂ ਦੇ ਪਲ ਆਪਾਂ ਸੁਣ ਸਕਦੇ ਹਾਂ ਉਹਨਾਂ ਦੀਆਂ ਬਾਤਾਂ ਸੁਣ ਸਕਦੇ ਹਾਂ ਇਸ ਤਰ੍ਹਾਂ ਸਾਡੇ ਕ ਜਿਵੇਂ ਦਾਦੀ ਜੀ ਮੇਰੇ ਸਾਨੂੰ ਸੁਣਾਉਂਦੇ ਹੁੰਦੇ ਸਨ ਕਿ ਵੀ ਮੇਰੇ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਉਹਨਾਂ ਵੇਲੇ ਕੀ ਹੁੰਦਾ ਸੀ ਅਸੀਂ ਉਹ ਕੀ ਖਾਂਦੇ ਸੀ ਕੀ ਪਹਿਨਦੇ ਸੀ ਕਿਵੇਂ ਰਹਿਣ ਸਹਿਣ ਸੀ ਉਹਨਾਂ ਦੇ ਪਾਪਾ ਜੀ ਉਹਨਾਂ ਦੇ ਪਾਪਾ ਜੀ ਉਹਨਾਂ ਨੂੰ ਕਿਵੇਂ ਕਿਵੇਂ ਸਮਝਾਉਂਦੇ ਸਨ ਕੀ ਪੜ੍ਹਾਉਂਦੇ ਸਨ ਜਾਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਹਮੇਸ਼ਾ ਸੁਣਾਉਂਦੇ ਹੁੰਦੇ ਸਨ ਇਸ ਤਰ੍ਹਾਂ ਕੀ ਹੈ ਹੋ ਤਾਂ ਹੀ ਇਹਨਾਂ ਬਾਤਾਂ ਕਰਕੇ ਇਹਨਾਂ ਗੱਲਾਂ ਕਰਕੇ ਇਹ ਤਾਂ ਤਾਂ ਹੀ ਤਾਂ ਜ਼ਿੰਦਗੀ ਵਿੱਚ ਪਿਆਰ ਅਤੇ ਗੁ ਪਿਆਰ ਵਿੱਚ ਹੋਰ ਗੂੜ੍ਹਾਪਣ ਆਇਆ ਹੈ ਮੈਂ ਇਸ ਤੋਂ ਆਪਾਂ ਸਟਾਰਗੇਜਿੰਗ ਵਿੱਚ ਇਹ ਜ਼ਰੂਰ ਆਪਾਂ ਕਹਿ ਸਕਦੇ ਹਾਂ ਵੀ ਹਾਂ ਇਸ ਨਾਲ ਪਿਆਰ ਅਤੇ ਪਿਆਰ ਵੱਧ ਹੈ ਅਤੇ ਰਿਸ ਬੰਧਨਾਂ ਵਿੱਚ ਗੂੜ੍ਹਾਪਣ ਆਉਂਦਾ ਹੈ ਧੰਨਵਾਦ